ਅਸੀਂ ਜੋ ਵੀ ਵਿਆਹ ਕਰਦੇ ਆ ਰਹੇ ਹਾਂ ਪਹਿਲਾਂ ਵੀ ਕਰਦੇ ਸੀ ਪਹਿਲਾਂ ਕੀ ਹੁੰਦਾ ਸੀਗਾ ਕਿ ਅਸੀਂ ਆਪਣੇ ਹਿਸਾਬ ਨਾਲ ਆਪਣੇ ਮਨੋਰੋਜਨ ਨਾਲ਼ ਆਪਣੇ ਸੱਭਿਆਚਾਰ ਦੇ ਨਾਲ਼ ਮਿਲ ਕੇ ਕੰਮ ਕਰਦੇ ਸੀ ਤਿੰਨ ਤਿੰਨ ਪੰਜ ਪੰਜ ਸੱਤ ਸੱਤ ਦਿਨ ਦੇ ਵਿਆਹ ਹੁੰਦੇ ਸੀ ਹੁਣ ਕੀ ਹੋ ਰਿਹਾ ਇੱਕ ਦਿਨ 'ਚ ਦੇ ਵਿੱਚ ਅਸੀਂ ਵਿਆਹ ਪੂਰਾ ਕਰ ਦਿੰਦੇ ਹਾਂ ਉਹਦੇ ਵਿੱਚ ਅਸੀਂ ਸਿਰਫ ਕੀ ਕਰ ਰਹੇ ਹਾਂ ਆਪਣੇ ਜਿਹੜੀ ਹੋਂਦ ਹੈ ਉਹਨੂੰ ਦਿਖਾ ਰਹੇ ਕਿ ਸਾਡੇ ਕੋਲ਼ ਕਿੰਨਾ ਪੈਸਾ ਹੈ ਅਸੀਂ ਕਿੰਨੀ ਪਹੁੰਚ ਵਾਲੇ ਹਾਂ ਲੇਕਿਨ ਉਹਦੇ ਵਿੱਚ ਮਨੋਰੰਜਨ ਜਾਂ ਆਪਣਾ ਸੱਭਿਆਚਾਰ ਬਿਲਕੁਲ ਖਤਮ ਹੁੰਦਾ ਜਾ ਰਿਹਾ ਇਹਦੇ ਵਿੱਚ ਕੀ ਆ ਰਿਹਾ ਨਸ਼ਾ ਆ ਰਿਹਾ ਬੰਦੂਕਾਂ ਠੀਕ ਹੈ ਅਤੇ ਉਹਦੇ ਨਾਲ਼ ਨਾਲ਼ ਅਸੀਂ ਆਪਣੇ ਆਪ ਨੂੰ ਇਹ ਸ਼ੋਅ ਅੱਜ ਕਰ ਰਹੇ ਹਾਂ ਕਿ ਅਸੀਂ ਕਿੰਨੇ ਕੁ ਵੱਡੇ ਹਾਂ ਕਿੰਨਾ ਸਾਡੇ ਕੋਲ ਪੈਸਾ ਹੈ ਲੇਕਿਨ ਸਾਡਾ ਸੱਭਿਆਚਾਰ ਜਿਹੜਾ ਹੈਗਾ ਉਹ ਬਿਲਕੁਲ ਖ਼ਤਮ ਹੁੰਦਾ ਜਾ ਰਿਹਾ